ਅਸੀਂ ਸਭ ਤੋਂ ਲੰਬਾ ਸਫ਼ਰ ਆਪਣੇ ਬਾਈਕ 'ਤੇ ਤੈਅ ਕੀਤਾ ਸੀਗਾ ਜੀ ਸ਼ਿਮਲੇ ਦਾ ਜਿਸ ਵਿੱਚ ਸਾਨੂੰ ਮਤਲਬ ਕਿ ਆਨੰਦ ਤਾਂ ਬਹੁਤ ਆਇਆ ਪਰ ਆਨੰਦ ਦੇ ਨਾਲ ਨਾਲ ਕਹਿੰਦੇ ਨਹੀਂ ਹੁੰਦੇ ਕਿ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਜੇ ਸਾਨੂੰ ਆਨੰਦ ਵੀ ਆਇਆ ਤਾਂ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਮੁਸੀਬਤਾਂ ਵੀ ਕੁਝ ਜ਼ਿਆਦਾ ਖ਼ਾਸ ਨਹੀਂ ਸੀ ਕਿਉਂਕਿ ਇਸ ਅਸੀਂ ਮਤਲਬ ਕੇ ਤਕਰੀਬਨ ਦੁਪਹਿਰ ਦੇ ਢਾਈ ਤਿੰਨ ਵਜੇ ਇੱਥੋਂ ਨਿਕਲੇ ਸੀ ਜਾਂਦੇ ਜਾਂਦੇ ਸਾਨੂੰ ਬੋਝ ਹੀ ਜਾਮ ਦਾ ਜੋ ਮੇਨ ਕਾਰਨ ਹੈ ਜਾਮ ਦਾ ਸਾਹਮਣਾ ਕਰਨਾ ਪਿਆ ਬਹੁਤ ਹੀ ਜਾਮ ਸੀ ਸਾਡਾ ਕੋਲ ਬਾਇਕ ਸੀ ਤਾਂ ਅਸੀਂ ਮਤਲਬ ਕਿ ਥੋੜ੍ਹਾ ਜਿਹਾ ਸਾਨੂੰ ਕਸ਼ਟ ਘੱਟ ਹੋਇਆ ਜੋ ਗੱਡੀਆਂ ਵਾਲੇ ਸੀ ਉਹਨਾਂ ਨੂੰ ਚਾਰ ਚਾਰ ਘੰਟੇ ਪੰਜ ਪੰਜ ਘੰਟੇ ਜਾਮ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਗਏ ਤਾਂ ਹਨੇਰੇ ਵਿੱਚ ਜੋ ਕਾਰਾਂ ਵਾਲੇ ਹਨ ਉਹ ਮਤਲਬ ਕਿ ਹਾਈ ਬੀਮ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਨ ਜਿਸ ਕਾਰਨ ਕੋਈ ਗਰੀਬ ਜੋ ਮੋਬਾਈਲ ਜੋ ਮਤਲਬ ਕਿ ਆਪਣਾ ਬਾਇਕ 'ਤੇ ਜਾ ਰਿਹਾ ਉਸਨੂੰ ਸਾਹਮਣੇ ਕੁਛ ਨਹੀਂ ਦਿਖਾਈ ਦੇ ਰਿਹਾ ਉਹ ਮਤਲਬ ਕਿ ਇੱਕ ਤਰ੍ਹਾਂ ਅੰਨਾ ਹੋ ਰਿਹਾ ਹੈ ਮਤਲਬ ਕਿ ਕੁਛ ਨਹੀਂ ਇਸ ਤਰ੍ਹਾਂ ਬੁਸ਼ ਕਾਰ ਦਾ ਵੀ ਮੇਰੇ ਸਾਹਮਣੇ ਦੋ ਤਿੰਨ ਜਣਿਆਂ ਦਾ ਐਕਸੀਜੈਨਟ ਹੋਣ ਤੋਂ ਬਚਿਆ ਕਾਰਨ ਇਹ ਹੀ ਸੀ ਕਿ ਹਾਈ ਵੀਮ ਸੀ ਗੱਡੀਆਂ ਦੇ ਤਾਂ ਮੈਂ ਇਹ ਹੀ ਕਹੂੰਗਾ ਕਿ ਸ ਮਤਲਬ ਕਿ ਥੋੜ੍ਹਾ ਜਿਹਾ ਧਿਆਨ ਨਾਲ ਜੋ ਕਾਰਾਂ ਵਾਲੇ ਹੁੰਦੇ ਹਨ ਉਹ ਮਤਲਬ ਕਿ ਥੋੜ੍ਹਾ ਧਿਆਨ ਨਾਲ ਆਪਣਾ ਚਲਾਵ ਚਲਾਵ ਤੋਰਾ ਫੇਰੀ ਦਾ ਕਰਨ ਅਤੇ ਦੂਜਾ ਮੁਸ਼ਕਲਾਂ ਦਾ ਸਾਹਮਣੇ ਇਹ ਵੀ ਆਇਆ ਜਦੋਂ ਉੱਥੇ ਪੁੱਜੇ ਤਾਂ ਉੱਥੇ ਰਹਿਣੇ ਪੀਣੇ ਖਾਣੇ ਦੀ ਬਹੁਤ ਪਰੇਸ਼ਾਨੀ ਸੀ ਪਾਣੀ ਸਾਫ਼ ਨਹੀਂ ਸੀ ਤਾਂ ਆਹੀ ਸੀ ਬਾਕੀ ਅਨੰਦ ਬਹੁਤ ਆਇਆ ਜੀ ਹਾਂ ਸਵਾਦ ਪੂਰਾ ਤਾਂ ਪੂਰਾ ਸਨੋਅ ਦਾ ਜਿਸ ਮਹੀਨੇ ਵਿੱਚ ਅਸੀਂ ਗਏ ਤਾਂ ਉੱਥੇ ਬਰਫ਼ ਪਈ ਨਹੀਂ ਸੀ ਬਸ ਆਹ ਹੀ ਗਮ ਰਹਿ ਗਿਆ ਜੀ ਹਾਂਜੀ